ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤਰਸੇਮ ਸਿੰਘ ਗੱਲ ਕਰ ਰਿਹਾ ਹਾਂਜੀ ਪੰਜਾਬੀ ਭੰਡਾਰ ਮਾਨਸਾ ਤੋਂ ਬੋਲ ਰਿਹਾ ਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਮੈਂ ਹਾਂਜੀ ਇੱਕ ਵਾਰੀ ਤਾਂ ਬਸ ਝੋਨੇ ਲੱਗ ਰਹੇ ਆ ਮੰਨ ਲਉ ਪਨੀਰੀ ਪਨੀਰੀ ਹਾਂਜੀ ਪਨੀਰੀ ਲੱਗ ਰਹੀ ਆ ਪਨੀਰੀ ਲੱਗਣ ਤੋਂ ਬਾਅਦ ਉਹਨਾਂ ਨੂੰ ਪਾਣੀ ਲਾ ਪਾਣੀ ਲਗਾਇਆ ਜਾਂਦਾ ਅਤੇ ਉਹਦੇ ਵਿੱਚ ਜਾਲਾ ਕਾਇਮ ਕਰ ਲਈ ਨਾ ਪੁਦਾਨ ਪਾਈ ਜਾਂਦੀ ਆ ਹਾਂਜੀ ਤੁਸੀਂ ਪੁਦਾਨ ਖਰੀਦ ਲਉ ਹਾਂਜੀ ਅਤੇ ਕਿੰਨਾ ਕਿੰਨਾ ਏਰੀਆ ਲਾਇਆ ਹੋਇਆ ਤੁਸੀਂ ਮਤਲਬ ਕਿੰਨੇ ਕਿੱਲੇ ਲੱਗੇ ਹੋਏ ਆ ਹਾਂਜੀ ਪੰਦਰਾਂ ਕਿੱਲਿਆਂ ਵਿੱਚ ਮੰਨ ਲਉ ਪੁਦਾਨ ਜਿਹੜੀ ਹੈਗੀ ਆ ਮੰਨ ਲਉ ਉਹ ਪੈ ਜਾਂਦੀ ਹੈ ਜੀ ਪੰਦਰਾਂ ਗੱਟੇ ਪੈ ਜੂਗੀ ਕਿੱਲੇ ਦਾ ਇੱਕ ਗੱਟਾ ਪੈ ਜਾਂਦਾ ਹੈਗਾ ਅਤੇ ਉਹਨਾਂ ਨੂੰ ਮੰਨ ਲਉ ਗਲਬਜ਼ ਚੜ੍ਹਾ ਕੇ ਆਪਣੇ ਹੱਥਾਂ 'ਤੇ ਅਤੇ ਫਿਰ ਉਹ ਉਹਨੂੰ ਘੋਲ ਕੇ ਅਤੇ ਉਹਦੇ ਵਿੱਚ ਮੂੰਹ ਬੰਨ੍ਹਣਾ ਪੈਂਦਾ ਅਤੇ ਫਿਰ ਛੱਡਣਾ ਪੈਂਦਾ ਜੀ ਠੀਕ ਆ ਉਹਦੇ ਨਾਲ ਇੱਕ ਇਹਦੇ ਵਿੱਚ ਜਾਲਾ ਕਾਇਮ ਹੋ ਜਾਂਦਾ ਮੰਨ ਲਉ ਅਤੇ ਹਾਂਜੀ ਅਤੇ ਇਹਦੀਆਂ ਜੜ੍ਹਾਂ ਵਿੱਚ ਮੰਨ ਲਉ ਪਾਣੀ ਖੜ੍ਹਨ ਲੱਗ ਜਾਂਦਾ ਹੈਗਾ ਝੋਨੇ ਦੇ ਅਤੇ ਫਿਰ ਬਾਕੀ ਜਿਹੜਾ ਹੈਗਾ ਅਤੇ ਪੁਦਾਨ ਤੋਂ ਬਾਅਦ ਤਿੰਨ ਚਾਰ ਪਾਣੀ ਲੱਗਣਗੇ ਤਿੰਨ ਚਾਰ ਪਾਣੀਆਂ ਤੋਂ ਬਾਅਦ ਫਿਰ ਇਹਨੂੰ ਮੰਨ ਲਉ ਅੱਗੇ ਸਪਰੇ ਦੀ ਲੋੜ ਹੋਊਗੀ ਉਹ ਫੰਗਸ ਹਾਂਜੀ ਉਹ ਫੰਗਸ ਹੁੰਦੀ ਆ ਜੇ ਉਹ ਮੰਨ ਲਉ ਪੈਂਦੀ ਆ ਤਾਂ ਫਿਰ ਆਪਾਂ ਉਹ ਦੇਵਾਂਗੇ ਤੁਹਾਨੂੰ ਸਪਰੇ ਜੇ ਨਹੀਂ ਤਾਂ ਫਿਰ ਉਹ ਇੱਕ ਨੋਰਮਲ ਸਪਰੇ ਆਉਂਦੀ ਆ ਉਹ ਤੁਹਾਨੂੰ ਦੇ ਦਿਆਂਗੇ ਊਂ ਉਤ ਉਹਦਾ ਤੁਸੀਂ ਛਿਕ ਛਿੜਕਾਅ ਕਰੀ ਰੱਖਿਓ ਅਤੇ ਬਸ ਮੰਨ ਲਉ ਵੀ ਆਪਣਾ ਝੋਨਾ ਜਿਹੜਾ ਉਹ ਸਹੀ ਰਹੇਗਾ ਵਧੀਆ ਰਹੇਗਾ ਕਿਉਂਕਿ ਐਂ ਨਾ ਜੀ ਤੁਸੀਂ ਤੁਹਾਡਾ ਤੁਸੀਂ ਸਾਡੀ ਦੁਕਾਨ ਦਾ ਐਨਾ ਨਾਮ ਸੁਣਿਆ ਤਾਂ ਅਸੀਂ ਬੰਦੇ ਨੂੰ ਸਹੀ ਗਾਈਡ ਕਰ ਰਹੇ ਹਾਂ ਅਸੀਂ ਉਹਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਪਾਂ ਤੁਹਾਨੂੰ ਵੀ ਜ਼ਿਆਦਾ ਕੋਸਟਲੀ ਨਹੀਂ ਲਾਵਾਂਗੇ ਆਪਾਂ ਸਹੀ ਰੇਟ ਮੰਨ ਲਉ ਜ ਜੋ ਵੀ ਰੇਹ ਦਾ ਸਪਰੇ ਦਾ ਹੋਊਗਾ ਸਹੀ ਰੇਟ ਲਾਵਾਂਗੇ ਕਿਉਂਕਿ ਆਪਣੀ ਦੁਕਾਨ ਤਾਂ ਹੀ ਮਸ਼ਹੂਰ ਆ ਕਿਉਂਕਿ ਆਪਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਤੁਸੀਂ ਕੋਈ ਨਹੀਂ ਬੇਫਿਕਰ ਰਹੋ ਤੁਸੀਂ ਮੋਸਟ ਵੈਲਕਮ ਤੁਸੀਂ ਆਉ ਸਾਡੀ ਦੁਕਾਨ 'ਤੇ ਅਸੀਂ ਤੁਹਾਨੂੰ ਸਹੀ ਗਾਈਡ ਕਰਾਂਗੇ ਅਤੇ ਮੰਨ ਲਉ ਝੋਨੇ ਨੂੰ ਸਹੀ ਰੱਖਣ ਵਾਸਤੇ ਸਹੀ ਟ੍ਰੀਟਮੈਂਟ ਉਹਦਾ ਦੇਵਾਂਗੇ ਅਸੀਂ ਜੋ ਵੀ ਤੁਹਾਨੂੰ ਸਪਰੇ ਚਾਹੀਦੀ ਹੋਊਗੀ ਜਿਸ ਤਰ੍ਹਾਂ ਦੀ ਕੰਡੀਸ਼ਨ ਹੋਊਗੀ ਉਸ ਤਰ੍ਹਾਂ ਦੀ ਉਹਨੂੰ ਮ ਮਤਲਬ ਆਪਾਂ ਦਵਾਈ ਤੁਹਾਨੂੰ ਦੇ ਦਿਆਂਗੇ ਉਹਦਾ ਤੁਸੀਂ ਛਿੜਕਾਅ ਕਰਵਾ ਦਿਉ ਆਪਣੇ ਬੰਦਿਆਂ ਤੋਂ ਹਾਂ ਓਕੇ ਮੈਮ